ਜੀ ਮੈਂ ਸਕੈਚ ਦੀ ਸਕੈਚ ਤੋਂ ਇੱਕ ਚਿੱਤਰ ਬਣਾ ਚਿੱਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਨੂੰ ਇਹ ਕੰਮ ਕਰਨਾ ਬਹੁਤ ਪਸੰਦ ਹੈ ਮੈਂ ਆਪਣੇ ਫਰੀ ਟਾਈਮ ਵਿੱਚ ਕਾਫੀ ਸਕੈਚਸ ਬਣਾ ਲੈਂਦੀ ਹਾਂ ਜੋ ਮੈਂ ਸੋਚਦੀ ਹਾਂ ਜਾਂ ਜੋ ਮੇਰੇ ਖਿਆਲ ਹੁੰਦੇ ਆ ਉਹਨੂੰ ਮੈਂ ਸਕੈਚ ਦੀ ਮਦਦ ਨਾਲ ਇੱਕ ਪੇਪਰ 'ਤੇ ਉਤਾਰ ਦਿੰਦੀ ਹਾਂ ਇਹ ਕਰਨ ਨਾਲ ਬਹੁਤ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਮੇਰੇ ਦਿਮਾਗ ਅਤੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਮੈਂ ਆਪਣੇ ਫਰੀ ਟਾਈਮ ਵਿੱਚ ਆਪਣੇ ਵੇਹਲੇ ਟਾਈਮ ਵਿੱਚ ਕਲਾ ਅਤੇ ਸ਼ਿਲਪਕਾਰੀ ਵੀ ਕਰਦੀ ਹਾਂ ਜਿਸ ਵਿੱਚ ਮੈਂ ਜੇ ਜੋ ਜਿਹੜੇ ਖਰਾਬ ਜਾਂ ਜਿਹਨੂੰ ਆਪਾਂ ਕੂੜਾ ਕਹਿ ਦਿੰਦੇ ਹਾਂ ਜਿਵੇਂ ਆਪਾਂ ਦੇ ਆਪਾਂ ਆਈਸਕ੍ਰੀਮ ਖਾਂਦੇ ਹਾਂ ਉਦੋਂ ਜਿਹੜੀ ਸਟਿਕਸ ਹੁੰਦੀ ਹੈ ਉਹ ਰਹਿ ਜਾਂਦੀਆਂ ਨੇ ਉਹ ਆਈਸਕ੍ਰੀਮ ਸਟਿਕਸ ਨੂੰ ਇਕੱਠਾ ਕਰਕੇ ਮੈਂ ਛੋਟੇ ਹੁੰਦੇ ਆਈਸਕ੍ਰੀਮ ਸਟਿਕਸ ਨੂੰ ਇਕੱਠਾ ਕਰਕੇ ਇੱਕ ਫੋਟੋ ਫਰੇ ਫੋਟੇ ਫਰੇਮ ਬਣਾਇਆ ਸੀ ਜਿਸ ਵਿੱਚ ਮੈਂ ਚ ਆਹ ਚਾਰ ਸਟਿੱਕਸ ਨੂੰ ਜੋੜ ਕੇ ਇੱਕ ਸਕੇਅਰ ਦੀ ਫੋਰਮ ਵਿੱਚ ਬਣਾ ਕੇ ਅਤੇ ਇਹੋ ਜਿਹੇ ਚਾਰ ਪੰਜ ਹੋਰ ਸਕੇਅਰ ਬਣਾ ਕੇ ਉਨ ਉਹਨਾਂ ਨੂੰ ਇੱਕ ਕੋਲਾਜ ਦੀ ਤਰ੍ਹਾਂ ਜੋੜ ਕੇ ਉਸ ਵਿੱਚ ਫੋਟੋਆਂ ਲਾਣ ਲਈ ਸਪੇਸ ਬਣਾ ਕੇ ਅਤੇ ਉਸ ਸਟਿਕਸ ਨੂੰ ਪੇਂਟ ਕਰਕੇ ਆਪਣੇ ਆਪਣੇ ਇੰਟਰਸਟ ਅਤੇ ਆਪਣੇ ਚੋਇਸ ਦੇ ਅਕੋਰਡਿੰਗ ਸਜਾ ਕੇ ਮੈਂ ਉਹਨੂੰ ਸਜਾਇਆ ਸੀ ਅਤੇ ਉਸ ਵਿੱਚ ਫੋਟੋਆਂ ਵੀ ਲਗਾਈਆਂ ਸੀ ਇਸਦੀ ਮੇਰੇ ਕੋ ਆਹਾ ਇਸਦੀ ਮੇਰੇ ਕੋਲ ਇੱਕ ਹੋਰ ਕਹਾਣੀ ਵੀ ਹੈ ਜਦ ਮੈਂ ਇੱਕ ਪਲਾਸਟਿਕ ਬੋਟਲ ਤੋਂ ਪਲਾਸਟਿਕ ਬੋਟਲ ਜਿਹੜੀ ਆਪਾਂ ਵੇਸਟ ਕਹਿ ਦਿੰਦੇ ਹਾਂ ਜਿਹਨੂੰ ਉਹਨੂੰ ਕ ਕੱਟ ਕੇ ਅਤੇ ਪੇਂਟ ਕਰਕੇ ਇੱਕ ਆਹ ਗਮਲਾ ਬਣਾਇਆ ਗਮਲਾ ਟਾਈਪ ਬਣਾਇਆ ਸੀ ਜਿਹਦੇ ਵਿੱਚ ਇੱਕ ਮੈਂ ਛੋਟਾ ਜਿਹਾ ਇੱਕ ਪੌਦਾ ਲਗਾਇਆ ਸੀ ਅਤੇ ਉਹ ਹਜੇ ਵੀ ਮੇਰੇ ਘਰ ਵਿੱਚ ਐਜ਼ ਆ ਡੈਕੋਰੇਸ਼ਨ ਐਂਡ ਐਜ਼ ਅ ਇੱਕ ਲਾਈਫ ਹੈ ਅਤੇ ਜਿਹੜੀ ਇਹ ਕਲਾ ਅਤੇ ਜਿਹੜਾ ਆਰਟ ਐਂਡ ਕਰਾਫਟ ਹੈ ਉਹ ਉਸਦੀ ਮਦਦ ਨਾਲ ਆਪਾਂ ਕਾਫੀ ਹੋਰ ਚੀਜ਼ਾਂ ਵੀ ਬਣਾ ਸਕਦੇ ਹਾਂ ਜਿਸ ਨੂੰ ਆਪਾਂ ਆਪਣੇ ਘਰ ਦੇ ਸਜਾ ਆਹ ਸਜਾਵਟ ਵਿੱਚ ਵੀ ਰੱਖ ਸਕਦੇ ਹਾਂ